ਜਾਨਵਰ ਉਤਪਾਦਾਂ ਦੀ ਪ੍ਰੋਸੈਸਿੰਗ ਦੇ ਆਮ ਤਰੀਕੇ ਵਿੱਚ ਇੱਕ ਕਿਸਾਈ ਕਸਾਈ ਵੱਲੋਂ ਜਾਨਵਰ ਨੂੰ ਖਰੀਦਿਆ ਜਾ ਜਾਂਦਾ ਹੈ ਉਸ ਨੂੰ ਫਿਰ ਵਧੀਆ ਖੁਰਾਕ ਦੇਣ ਤੋਂ ਬਾਅਦ ਬੜਾ ਹੋ ਕਰਨ ਤੋਂ ਬਾਅਦ ਉਸ ਨੂੰ ਬ ਕਤਲ ਕਰਕੇ ਉਸ ਦਾ ਮੀਟ ਤਿਆਰ ਕਰਕੇ ਖਰੀਦਦਾਰਾਂ ਕੋਲ ਵੇਚਣ ਦੇ ਲਈ ਭੇਜ ਦਿੱਤਾ ਜਾਂਦਾ ਹੈ ਖਰੀਦਦਾਰ ਨੇ ਜਿਹੜੇ ਨੇ ਉਸ ਮੀਟ ਨੂੰ ਖਰੀਦਦੇ ਹਨ ਅਤੇ ਫਿਰ ਆਮ ਲੋਕਾਂ ਦੇ ਵਿੱਚ ਉਨ੍ਹਾਂ ਨੂੰ ਵੇਚ ਦਿੱਤਾ ਜਾਂਦਾ ਹੈ